ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਇੱਥੇ ਨਵਾਂ ਰਹਿਣ ਵਾਲਾ ਅਤੇ ਮੈਨੂੰ ਨਾ ਬੋਲੀਵੁੱਡ ਦੀ ਕੁਛ ਪਰਸਨੈਲਿਟੀਜ਼ ਦੱਸੋ ਜ਼ਰਾ ਕੋਈ ਨਵੀਂ ਨਵੀਂ ਮੇਰਾ ਨਾਮ ਤਲਵਿੰਦਰ ਹੈ ਜੀ ਅੱਛਾ ਅੱਛਾ ਭਾਅ ਜੀ ਠੀਕ ਹੈ ਅਤੇ ਹੋਰ ਕੋਈ ਇੱਕ ਦੋ ਦ ਤੁਸੀਂ ਦੱਸ ਸਕਦੇ ਹੋ ਤਾਂ ਓਕੇ ਓਕੇ ਓ ਓਕੇ ਭਾਅ ਜੀ ਥੈਂਕ ਯੂ ਫੌਰ ਦਾ ਇਨਫੋਰਮੇਸ਼ਨ ਓਕੇ ਭਾਅ ਜੀ ਬਾਏ